ਸਤਿ ਸ਼੍ਰੀ ਅਕਾਲ ਹਾਂਜੀ ਦੱਸੋ ਗਰਮੀਆਂ ਦੇ ਵਿੱਚ ਅਲੱਗ ਤੋਂ ਅਲੱਗ ਤਰ੍ਹਾਂ ਦੀਆਂ ਸਬਜ਼ੀਆਂ ਵਗੈਰਾ ਜਾਂ ਫਿਰ ਕਣਕ ਵਗੈਰਾ ਬੀਜੀ ਜਾਂਦੀ ਆ ਸਬਜ਼ੀਆਂ ਜਿਵੇਂ ਕੱਦੂ ਭਿੰਡੀ ਤੋਰੀਆਂ ਜਾਂ ਟਮਾਟਰ ਵਗੈਰਾ ਲਾਏ ਜਾਂਦੇ ਆ ਗੋਭੀ ਵੀ ਹੋ ਗਈ ਕਾਫੀ ਤਰ੍ਹਾਂ ਦੀਆਂ ਸਬਜ਼ੀਆਂ ਜਿਹੜੀਆਂ ਉਗਾਈਆਂ ਜਾਂਦੀਆਂ ਨੇ ਇਹਨਾਂ ਦੇ ਕਾਫੀ ਫਾਇਦੇ ਨੇ ਆਪਣੇ ਨੂੰ ਜਿਵੇਂ ਗਰਮੀਆਂ ਦੇ ਵਿੱਚ ਆਪਾਂ ਨੂੰ ਠੰਡਾ ਰੱਖਦੀਆਂ ਨੇ ਆਪਣੇ ਸਰੀਰ ਨੂੰ ਗਰਮੀ 'ਚ ਨਹੀਂ ਤਾਂ ਗਰਮੀ ਨੇ ਜਿਵੇਂ ਆਪਾਂ ਮਿਰਚ ਮਸਾਲੇ ਪਾ ਦਿੰਦੇ ਆ ਜਲਨ ਨਹੀਂ ਕਰਦੀਆਂ ਇਹ ਸਬਜ਼ੀਆਂ ਕਈ ਕੁਦਰਤੀ ਹੁੰਦੀਆਂ ਅਸੀਂ ਬਿਨਾਂ ਰੇਅ ਸਪਰੇ ਤੋਂ ਬਣਾਉਂਦੇ ਹਾਂ ਸਿੰਪਲ ਘਰ ਦੀਆਂ ਉਗਾਈਆਂ ਹੁੰਦੀਆਂ ਜਿਵੇਂ ਉੱਦਾਂ ਹੀ ਜਿਹਦੇ ਨਾਲ ਕੋਈ ਆਪਣੀ ਸਿਹਤ ਨੂੰ ਹੁੰਦਾ ਨਹੀਂ ਹਾਂ ਹਾਂਜੀ ਨਹੀਂ ਆਪਾਂ ਹਰ ਸਬਜ਼ੀ ਦੇ ਵਿੱਚ ਪਾ ਲੈਂਦੇ ਹਾਂ ਟਮਾਟਰ ਨੂੰ ਜਿਵੇਂ ਬੱਚੇ ਕਈ ਉਹ ਕਈ ਲੋਕ ਸਲਾਦ ਦੇ ਤੌਰ 'ਤੇ ਬਹੁਤ ਖਾ ਲੈਂਦੇ ਨੇ ਜਿਵੇਂ ਗਰਮੀਆਂ ਦੇ ਵਿੱਚ ਅੱਗੇ ਜਦੋਂ ਖਤਮ ਹੋਣ ਮੂਲੀਆਂ ਵਗੈਰਾ ਆ ਜਾਂਦੀਆਂ ਉਹ ਹੋ ਗਈ ਅਤੇ ਜਿਵੇਂ ਆਪਾਂ ਸਲਾਦ ਦੇ ਰੂਪ ਵਿੱਚ ਵੀ ਖਾ ਸਕਦੇ ਹਾਂ ਹਾਂ ਕਿਉਂਕਿ ਫਿਰ ਉਹ ਸਿਹਤ ਨੂੰ ਵੀ ਸਹੀ ਰੱਖਦੀਆਂ ਸਬਜ਼ੀਆਂ ਆਪਾਂ ਨੂੰ ਹਾਂਜੀ ਅਤੇ ਬਾਕੀ ਜਿਹੜੀ ਅਸੀਂ ਕਣਕ ਵਗੈਰਾ ਉਗਾਉਂਦੇ ਹਾਂ ਉਹਦੇ ਵਿੱਚ ਵੀ ਕੋਈ ਰੇਅ ਸਪਰੇਅ ਨਹੀਂ ਕਰਦੇ ਨਾ ਸਬਜ਼ੀਆਂ ਉਥੇ ਜਿਵੇਂ ਕਿ ਕੱਦੂ ਵਿੱਚ ਕਈ ਲੋਕੀ ਟੀਕੇ ਲਾ ਕੇ ਪਕਾ ਦਿੰਦੇ ਆ ਕਿ ਜਲਦੀ ਹੋ ਜਾਣ ਅਤੇ ਉਹ ਫਿਰ ਸਰੀਰ ਨੂੰ ਬਾਅਦ 'ਚ ਆਪਣੇ ਨੂੰ ਤੰਗ ਕਰਦੀਆਂ ਜਿਹਦੇ ਨਾਲ ਕਾਫੀ ਬਿਮਾਰੀਆਂ ਲੱਗ ਜਾਂਦੀਆਂ ਇਹਦੇ ਨਾਲ ਉਹ ਨਹੀਂ ਲੱਗਦੀਆਂ ਨਹੀਂ ਨਹੀਂ ਸਾਡੀ ਸਬਜ਼ੀ ਮੰਡੀ 'ਚ ਜਾਂਦੀ ਜਾਂ ਫਿਰ ਜਿਹਨਾਂ ਨੇ ਆਂਢ ਗੁਆਂਢ ਜਾਂ ਫਿਰ ਘਰੋਂ ਲੈ ਜਾਂਦਾ ਹੁੰਦਾ ਕੋਈ ਹਾਂਜੀ ਹੋਰ ਕੁਝ ਤੁਸੀਂ ਜਿਵੇਂ ਕਿ ਜੇ ਤੁਸੀਂ ਆਪਦੀ ਮਰਜ਼ੀ ਨਾਲ ਕੋਈ ਸਬਜ਼ੀ ਉਹ ਕਰਵਾਉਣੀ ਹੋਵੇ ਬਿਜਾਉਣੀ ਹੋਵੇ ਅਸੀਂ ਉਹ ਵੀ ਕਰਦੇ ਆ ਜਿਵੇਂ ਕਿ ਧਨੀਆ ਵਗੈਰਾ ਕਈ ਹੁੰਦਾ ਨਾ ਕੀ ਸਾਨੂੰ ਆਪਦੀ ਚਾਹੀਦੀ ਆ ਕਿਸੇ ਨੇ ਬਿਜਵਾਉਣੀ ਹੁੰਦੀ ਧਨੀਆ ਵਗੈਰਾ ਹਾਂਜੀ ਕੋਈ ਗੱਲ ਨਹੀਂ ਜਿਵੇਂ ਸਾਡੇ ਆਪਦੇ ਖੇਤ ਨੇ ਜਿੱਥੇ ਕਾਫੀ ਲਾਈਆਂ ਜਾਂਦੀਆਂ ਅਸੀਂ ਲਾਉਂਦੇ ਹਾਂ ਹਾਂਜੀ ਹਾਂਜੀ ਨਹੀਂ ਨਹੀਂ ਸਾਡੇ ਤਾਂ ਜਿਵੇਂ ਖੁਦ ਉਗਾਉਂਦੇ ਹਾਂ ਇਹ ਕਾਫੀ ਹੋ ਜਾਂਦੀਆਂ ਤੁਸੀਂ ਜਦੋਂ ਚਾਹੋ ਆ ਕੇ ਲੈ ਕੇ ਜਾ ਸਕਦੇ ਹੋ